ਪੰਜਾਬੀ ਸੱਭਿਆਚਾਰ ਭਾਰਤ ਦੇ ਦੂਸਰੇ ਰਾਜ ਦੇ ਸੱਭਿਆਚਾਰਾਂ ਨਾਲੋਂ ਬਹੁਤ ਭਿੰਨ ਹੈ ਸਾਡਾ ਸੱਭਿਆਚਾਰ ਵਿਰਸਾ ਬਹੁਤ ਹੀ ਅਮੀਰ ਹੈ ਪੰਜਾਬੀਆਂ ਦਾ ਰਹਿਣਾ ਸਹਿਣਾ ਖਾਣ ਪੀਣ ਪਹਿਰਾਵਾ ਖੁੱਲ੍ਹਾ ਡੁੱਲ੍ਹਾ ਹੈ ਇੱਥੋਂ ਦੀ ਵਿਰਾਸਤ ਇੱਥੋਂ ਦਾ ਮਿਊਜਿਕ ਇੱਥੋਂ ਦੇ ਚਿੱਤਰਕਾਰੀ ਇੱਥੋਂ ਦੀਆਂ ਕਵਿਤਾਵਾਂ ਸਭ ਭਾਰਤ ਦੇ ਦੂਸਰੇ ਰਾਜਾਂ ਤੋਂ ਉਹਨਾਂ ਦੇ ਸੱਭਿਆਚਾਰ ਤੋਂ ਬਿਲਕੁਲ ਹੀ ਵੱਖ ਹਨ ਸਾਡੀ ਪੰਜਾਬੀ ਸੱਭਿਆਚਾਰ ਦਾ ਦੂਸਰੇ ਰਾਜਾਂ 'ਤੇ ਬੜਾ ਪ੍ਰਭਾਵ ਹੈ ਖ਼ਾਸ ਕਰਕੇ ਪੰਜਾਬ ਦਾ ਜਿਹੜਾ ਸੰਗੀਤ ਹੈ ਉਸਨੇ ਤਾਂ ਸਾਰੇ ਭਾਰਤ ਕੀ ਸਾਰੇ ਦੂਸਰੇ ਮੁਲਕਾਂ ਵਿੱਚ ਵੀ ਧੂਮਾਂ ਪਾਈਆਂ ਹੋਈਆਂ ਹਨ ਬੋਲੀਵੁੱਡ ਦੀ ਕੋਈ ਵੀ ਫਿਲਮ ਜਿਹੜੀ ਹੈ ਪੰਜਾਬੀ ਸੰਗੀਤ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ